ਬਾਈਕਿੰਗ ਦਾ ਮੈਨੂੰ ਕਾਫੀ ਸ਼ੌਂਕ ਹੈਗਾ ਗਾ ਮੈਂ ਕਾਫੀ ਜਗ੍ਹਾ 'ਤੇ ਗਿਆ ਹੈਗਾ ਜਿਵੇਂ ਕਿ ਹਰਿਆਣਾ ਰਾਜਸਥਾਨ ਇੱਧਰ ਹਿਮਾਚਲ ਮੰਡੀ ਅਤੇ ਕਸ਼ਮੀਰ 'ਚ ਵੀ ਜੰਮੂ 'ਚ ਵੀ ਕਾਫੀ ਜਗ੍ਹਾ 'ਚ ਗਏ ਹਾਂ ਅਤੇ ਕਾਫੀ ਵਧੀਆ ਲੱਗਦਾ ਉਦੋਂ ਬਹੁਤ ਵਧੀਆ ਲੱਗਦਾ ਜਦੋਂ ਹੋਰ ਸਟੇਟ ਦੇ ਬੰਦੇ ਮਿਲਦੇ ਹੈਗੇ ਬਾਈਕਿੰਗ ਲਈ ਆਏ ਹੁੰਦੇ ਆ ਉਹ ਉੱਥੇ ਉਦੋਂ ਬਹੁਤ ਵਧੀਆ ਲੱਗਦਾ ਗਾ ਉਹਨਾਂ ਦੇ ਵਿਚਾਰ ਉਹਨਾਂ ਦੇ ਸੁਣਨੇ ਆਪਾਂ ਉਹਨਾਂ ਨੂੰ ਦੱਸਣੇ ਬਹੁਤ ਹੀ ਵਧੀਆ ਲੱਗਦੀ ਹੈਗੇ ਅਤੇ ਮੈਂ ਫਤਿਹਗੜ੍ਹ ਸਾਹਿਬ ਵੀ ਗਿਆ ਅਤੇ ਉੱਥੇ ਬਹੁਤ ਲੰਗਰ ਲੱਗੇ ਹੋਏ ਸੀਗੇ ਕਾਫੀ ਬਹੁਤ ਵਧੀਆ ਲੱਗਿਆ ਅਲੱਗ ਅਲੱਗ ਲੋਕਾਂ ਨਾਲ ਸਾਂਝ ਪਈ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ ਅਤੇ ਬਹੁਤ ਹੀ ਵਧੀਆ ਲੱਗਿਆ ਉਹਨਾਂ ਨਾਲ ਵੀ ਮੈਂ ਇੱਕ ਵਾਰੀ ਜੰਮੂ 'ਚ ਗਏ ਉੱਥੇ ਅਸੀਂ ਮੈਗੀ ਦੇ ਆਰਡਰ ਦਿੱਤੇ ਤਿੰਨ ਅਸੀਂ ਤਿੰਨ ਜਾਣੇ ਸੀਗੇ ਅਤੇ ਅਸੀਂ ਕਾਫੀ ਗੱਲਾਂ ਵੀ ਕੀਤੀਆਂ ਪਰਿਵਾਰਿਕ ਗੱਲਾਂ ਕੀਤੀਆਂ ਉਹਨੇ ਸਾਨੂੰ ਇੱਕ ਮੈਗੀ ਫਰੀ ਦਿੱਤੀ ਅਤੇ ਬੜਾ ਚੰਗਾ ਲੱਗਿਆ ਕਿ ਲੋਕ ਸੋਚਦੇ ਆ ਇਕ ਦੂਜੇ ਬਾਰੇ ਬਹੁਤ ਹੀ ਵਧੀਆ ਲੱਗੀ